ਅਸੀਂ ਯੋਗ ਕਿਸੇ ਵੀ ਸਮੇਂ ਕਰ ਸਕਦੇ ਹਾਂ ਪਰ ਖਾਣਾ ਖਾਣ ਤੋਂ ਤਿੰਨ ਘੰਟੇ ਬਾਅਦ ਯੋਗ ਦੀ ਹਰ ਕਿਰਿਆ ਸਾਡੇ ਸਰੀਰ ਦੇ ਹਰ ਹਿੱਸੇ 'ਤੇ ਪ੍ਰਭਾਵਕਾਰੀ ਹੁੰਦੀ ਹੈ ਜੋ ਇੱਕ ਸਰੀਰ ਜੋ ਇੱਕ ਮੌਲਿਕ ਕਿਰਿਆ ਜੋ ਸਾਨੂੰ ਇੱਕ ਖ਼ਾਸ ਹਿੱਸੇ ਨੂੰ ਦਰਦ ਤੋਂ ਰਹਿਤ ਅਤੇ ਉਸ ਬਿਮਾਰੀ ਤੋਂ ਮੁਕਤ ਕਰਨ ਲਈ ਕੀਤੀਆਂ ਜਾਂਦੀਆਂ ਹਨ ਬੇਸਿਕ ਯੋਗ ਕਿਰਿਆਵਾਂ ਸਾਨੂੰ ਆਪਣੀ ਰੂਟੀਨ ਵਿੱਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਤਾਂ ਕਿ ਸਰੀਰ ਨਿਰੋਗ ਰਹਿਤ ਹੋਏ ਇਸਤੋਂ ਇਲਾਵਾ ਪ੍ਰਾਣਾਯਾਮ ਕਰਨਾ ਬੜਾ ਹੀ ਜ਼ਰੂਰੀ ਹੈ ਜੋ ਕਿ ਸਾਡੇ ਸਰੀਰ ਦੇ ਅੰਦਰੂਨੀ ਯੋਗ ਕਿਰਿਆ ਹੁੰਦੀ ਹੈ ਜੋ ਸਾਡੀ ਅੰਦਰੂਨੀ ਅੰਗਾਂ ਨੂੰ ਤੰਦਰੁਸਤ ਰੱਖਦੀ ਹਨ ਜਿਵੇਂ ਅਨੁਲੋਮ ਵਿਲੋਮ ਕਪਾਲਭਾਤੀ ਆਦਿ ਇਹ ਯੋਗ ਕਿਰਿਆ ਸਾਨੂੰ ਰੋਜ਼ ਰੁਟੀਨ ਵਿੱਚ ਆਪਣੇ ਲਿਆਉਣੀ ਚਾਹੀਦੀ ਹੈ ਤਾਂ ਕਿ ਤੁਸੀਂ ਹਮੇਸ਼ਾ ਤੰਦਰੁਸਤ ਰਹਿ ਸਕੋ ਆਪਣੇ ਦਿਨ ਦੀ ਸ਼ੁਰੂਆਤ ਖੁੱਲ੍ਹੇ ਆਸਮਾਨ ਦੇ ਨੀਚੇ ਹਵਾਦਾਰ ਮਾਹੌਲ ਵਿੱਚ ਜਾਂ ਪਾਰਕ ਵਿੱਚ ਕਰਨੀ ਚਾਹੀਦੀ ਹੈ ਯੋਗ ਕਰਨਾ ਸਾਡੇ ਲਈ ਬਹੁਤ ਜ਼ਰੂਰੀ ਹੋ ਗਿਆ ਹੈ ਅੱਜ ਕੱਲ੍ਹ ਪਾਰਕਾਂ ਵਿੱਚ ਤਾਂ ਸਭ ਮਿਲ ਕੇ ਇਕੱਠ ਕਰਕੇ ਉੱਚੀ ਉੱਚੀ ਤਾੜੀਆਂ ਮਾਰ ਕੇ ਜਾਂ ਉੱਚੀ ਉੱਚੀ ਹੱਸ ਕੇ ਇਹ ਕਿਰਿਆ ਕਰਦੇ ਹਨ ਯੂੰ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰਦੇ ਹਨ ਬੁੱਢੇ ਤੋਂ ਬੁੱਢਾ ਆਦਮੀ ਅਤੇ ਜਵਾਨ ਤੋਂ ਜਵਾਨ ਬੱਚਾ ਵੀ ਇਸ ਕਿਰਿਆਵਾਂ ਨੂੰ ਕਰਨਾ ਜ਼ਰੂਰੀ ਸਮਝਦਾ ਹੈ ਤੰਦਰੁਸਤ ਰਹਿਣ ਲਈ ਸਾਨੂੰ ਇਸ ਕਿਰਿਆ ਨੂੰ ਆਪਣੇ ਜੀਵਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਯੋਗ ਕਿਰਿਆਵਾਂ ਕਰਨਾ ਅੱਜ ਦੇ ਯੁਗ ਵਿੱਚ ਬਹੁਤ ਜ਼ਰੂਰੀ ਹੋ ਗਿਆ ਹੈ ਤੁਸੀਂ ਵੀ ਆਪਣੇ ਜੀਵਨ ਵਿੱਚ ਇਸ ਨੂੰ ਸ਼ਾਮਲ ਕਰੋ